ਉਹ ਪ੍ਰੋਗਰਾਮ ਉਹ ਹਨ ਜਿੱਥੇ ਮੈਂ ਗੁਰੂ ਸਾਹਿਬ ਦੀ ਉਸਤਤ ਗਾਉਂਦੀ ਹਾਂ ਅਤੇ ਸਾਡਾ ਢਾਡੀ ਜੱਥਾ ਹੈ ਜਿੱਥੇ ਗੁਰੂ ਸਾਹਿਬ ਦੇ ਗੁੁਣ ਅਪਾਰ ਗਾਏ ਜਾਂਦੇ ਨੇ ਅਸੀਂ ਸੰਗਤਾਂ ਨੂੰ ਹਰਜਸ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਨੇ ਅਤੇ ਮੈਨੂੰ ਗੁਰਬਾਣੀ ਅਤੇ ਗੁਰਬਾਣੀ ਦੀਆਂ ਵਿਚਾਰਾਂ ਅਤੇ ਗੁਰਬਾਣੀ ਪ੍ਰਤੀ ਜੋ ਭਾਵਨਾ ਪਿਆਰ ਪ੍ਰਤੀ ਸਾਨੂੰ ਇੱਕ ਸਤਗੁਰ ਮਹਾਰਾਜ ਨੇ ਜਿਹੜੀ ਸਾਡੇ 'ਤੇ ਬਖਸ਼ਿਸ਼ ਕੀਤੀ ਹੈ ਸਾਨੂੰ ਮਤਲਬ ਗਾਉਣਾ ਬਹੁਤ ਪਸੰਦ ਹੈ ਧਾਰਮਿਕ ਪ੍ਰੋਗਰਾਮਾਂ 'ਤੇ ਜਾ ਕੇ ਅਸੀਂ ਸਟੇਜਾਂ 'ਤੇ ਗਾਉਂਦੇ ਹਾਂ ਸੰਗਤਾਂ ਨੂੰ ਨਿਹਾਲ ਕਰਦੇ ਹਾਂ ਸਤਿਗੁਰ ਮਹਾਰਾਜ ਨੇ ਬੜੀ ਅਪਾਰ ਕਿਰਪਾ ਕੀਤੀ ਹੈ ਅਤੇ ਬੜਾ ਵਧੀਆ ਲੱਗਦਾ ਹੈ ਜਦੋਂ ਅਸੀਂ ਸਟੇਜ ਅਤੇ ਸੰਗਤਾਂ ਨੂੰ ਰਾਗੀ ਢਾਡੀ ਅ ਦੇ ਨਾਲ ਅਸੀਂ ਸਰਵਣ ਕਰਵਾਉਂਦੇ ਹਾਂ